ਮੈਨੂੰ ਸੂਟਾਂ ਦੀ ਕੁਲੈਕਸ਼ਨ ਕਰਨਾ ਬਹੁਤ ਪਸੰਦ ਹੈ ਮੈਂ ਸੂਟਾਂ ਨੂੰ ਕਲੈਕਸ਼ਨ ਬਹੁਤ ਕਰਦੀ ਹੈਗੀ ਮੈਨੂੰ ਸੂਟ ਕੱਠੇ ਕਰਨਾ ਵਧੀਆ ਲੱਗਦਾ ਹੈ ਅੱਜ ਕੱਲ ਸੂਟਾਂ ਦਾ ਬਹੁਤ ਫੈਸ਼ਨ ਚੱਲਿਆ ਹੋਇਆ ਹੈ ਲੱਗ ਲੱਗ ਤਰਾਂ ਦੇ ਸੂਟ ਆਏ ਹੋਏ ਆ ਮਾਰਕੀਟ ਦੇ ਵਿੱਚ ਜਿਸ ਤਰਾਂ ਦਾ ਵੀ ਮਾਰਕੀਟ ਵਿੱਚ ਨਵਾਂ ਡਿਜ਼ਾਇਨ ਵਗੈਰਾ ਆਉਂਦਾ ਹੈ ਮੈਂ ਲੈ ਕੇ ਆਉਦੀ ਆ ਮੈਂ ਸੂਟ ਇਕੱਠੇ ਕਰਦੀ ਆਂ ਮੈਨੂੰ ਸੂਟ ਬਹੁਤ ਪਸੰਦ ਆ ਅੱਜ ਕੱਲ ਜਿਵੇਂ ਪਲਾਜੋ ਪਰਾਜੋ ਹੋ ਗਿਆ ਪੈਸਲ ਪਲਾਜੋ ਹੋ ਗਿਆ ਸ਼ਰਾਰਾ ਪੈ ਧੋਤੀ ਸਲਵਾਰ ਹੋਗੀ ਐਹੋ ਜਿਹਾ ਕੁਛ ਮੈਨੂੰ ਬਹੁਤ ਪਸੰਦ ਆ ਤੇ ਅਲੱਗ ਅਲੱਗ ਤਰਹਾਂ ਦੀਆਂ ਲੈਸਾਂ ਲਾਉਣੀਆਂ ਲਟਕਣ ਲਾਉਣੇ ਲਟਕਣ ਇਕੱਠੇ ਕਰਨੇ ਲੈਸਾਂ ਇਕੱਠੀਆਂ ਕਰਨੀਆਂ ਦੁਪੱਟਿਆਂ ਤੇ ਅਲੱਗ ਅਲੱਗ ਤਰ੍ਹਾਂ ਦੇ ਵੇਅਰ ਕਰਨੇ ਲੈਸਾਂ ਵਗੈਰਾ ਕਰਨੀਆਂ ਮੈਚਿੰਗ ਵਗੈਰਾ ਸੂਟਾਂ ਦੀ ਮੈਨੂੰ ਬਹੁਤ ਪਸੰਦ ਐ ਮੈਨੂੰ ਲੱਗਦਾ ਕਿ ਲੋਕਾਂ ਨੂੰ ਸੂਟ ਇਕੱਠੇ ਕਰਨੇ ਚਾਹੀਦੇ ਆਗੇ ਮੇਰੀ ਮੰਨਣ ਨੂੰ ਤਾਂ ਸੂਟ ਕੱਠੇ ਕਰਨੇ ਚਾਹੀਦੇ ਹੈਗੇ ਮੈਨੂੰ ਸੂਟ ਇਕੱਠੇ ਕਰਨਾ ਬਹੁਤ ਪਸੰਦ ਆ ਮੈਂ ਲੱਗ ਲੱਗ ਤਰਾਂ ਦੇ ਸੂਟ ਇਕੱਠੇ ਕਰਦੀ ਆਂ ਤੇ ਸੂਟਾਂ ਦੇ ਮਾਰਕਿਟ ਵਿੱਚ ਬਹੁਤ ਤਰਾਂ ਤਰਾਂ ਦੇ ਡਿਜਾਇਨ ਆਉਂਦੇ ਆਗੇ ਜਿਵੇਂ ਪਾਰਟੀ ਵਗੈਰਾ ਹੋ ਗਿਆ ਘਰੇ ਪਾਣ ਵਾਲੇ ਸੂਟ ਹੋਗੇ ਕੋਈ ਸਿਲਕ ਦੇ ਸਲੀਨ ਵੀ ਸੂਟ ਹੋਊਗੇ ਤੇ ਅਲੱਗ ਅਲੱਗ ਤਰਾਂ ਦੇ ਸੂਟ ਹੋਗੇ ਡਿਫਰੈਂਟ ਕਲਰ ਹੋਗੇ ਮੈਨੂੰ ਅਲੱਗ ਅਲੱਗ ਕਲਰਾਂ ਦੇ ਸੂਟ ਬਹੁਤ ਪਸੰਦ ਆ ਉਹਨਾਂ ਦੇ ਨਾਲ ਉਹਨਾਂ ਦੇ ਮੈਚਿੰਗ ਲਟਕਣ ਵਗੈਰਾ ਲੈਸਾਂ ਵਗੈਰਾ ਝੂਮਰ ਅੱਜ ਕੱਲ ਲਟਕਣ ਆਲੇ ਲੈਸ ਬਹੁਤ ਜਿਆਦਾ ਟ੍ਰੈਡਿੰਗ ਦੇ ਵਿੱਚ ਆ ਮੈਨੂੰ ਉਹ ਲੈਸ ਵਗੈਰਾ ਬਹੁਤ ਪਸੰਦ ਆ ਸੂਟਾਂ ਦੇ ਉੱਤੇ ਲਾ ਕੇ ਲਾਉਣਾ ਤੇ ਮੈਂ ਕਹਿੰਨੀ ਆ ਕੀ ਸਾਰਿਆਂ ਨੂੰ ਇਕੱਠੇ ਕਰਨੇ ਚਾਹੀਦੇ ਹੈਗੇ ਕਲੈਕਸ਼ਨ ਕਰਨੀ ਚਾਹੀਦੀ ਐ ਸੂਟਾਂ ਦੀ ਤੇ